ਉਝ ਤਾਂ ਸਾਡੇ ਇਲਾਕੇ ਵਿੱਚ ਬਹੁਤ ਸਾਰੇ ਧਾਰਮਿਕ ਅਸਥਾਨ ਹਨ ਪ੍ਰੰਤੂ ਮੈਂ ਮੋਹਾਲੀ ਜ਼ਿਲ੍ਹੇ ਵਿੱਚ ਸਥਿਤ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਆਮ ਕਰਕੇ ਜਾਂਦੀ ਹਾਂ ਕਿਸੇ ਅਸਥਾਨ ਨਾਲ਼ ਮੇਰਾ ਬਹੁਤ ਹੀ ਡੂੰਘਾ ਲਗਾਵ ਹੈ ਇਹ ਅਸਥਾਨ ਦਾ ਇਸਥ ਇਤਿਹਾਸ ਬਹੁਤ ਡੂੰਘਾਈ ਵਾਲਾ ਹੈ ਕਿਉਂਕਿ ਇੱਥੇ ਸਿੱਖ ਇਤਿਹਾਸ ਦੇ ਸਭ ਤੋਂ ਪਹਿਲੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਆਪਣੇ ਹੋਰ ਸਿੰਘਾਂ ਸ਼ਹੀਦੀਆਂ ਨਾਲ ਯੁੱਧ ਕਰਦੇ ਹੋਏ ਸ਼ਹੀਦ ਹੋਏ ਸਨ ਮੈਂ ਆਮ ਕਰਕੇ ਹਫਤੇ ਵਿੱਚ ਇੱਕ ਵਾਰ ਜਾਂਦੀ ਹਾਂ ਅਤੇ ਦਸਵੀਂ ਨੂੰ ਵੀ ਜਾਂਦੀ ਹਾਂ ਇਸ ਅਸਥਾਨ 'ਤੇ ਹਰ ਸਮੇਂ ਕੀਰਤਨ ਬਾਣੀ ਦਾ ਪਰਵਾਹ ਚੱਲਦਾ ਰਹਿੰਦਾ ਹੈ ਅਤੇ ਮੈਨੂੰ ਕੀਰਤਨ ਸੁਣਨ ਦਾ ਆਨੰਦ ਪ੍ਰਾਪਤ ਹੁੰਦਾ ਹੈ ਕੀਰਤਨ ਸੁਣਦਿਆਂ ਪਤਾ ਹੀ ਨਹੀਂ ਲੱਗਦਾ ਕਦੋਂ ਸਮਾਂ ਹੋ ਜਾਂਦਾ ਹੈ ਇਸ ਅਸਥਾਨ 'ਤੇ ਚੌਵੀ ਘੰਟੇ ਲੰਗਰ ਚੱਲਦਾ ਰਹਿੰਦਾ ਹੈ ਮੈਂ ਬਰਤਨਾਂ ਦੀ ਸੇਵਾ ਅਤੇ ਲੰਗਰ ਦੀ ਸੇਵਾ ਕਰਦੀ ਹਾਂ ਲੰਗਰ ਦੀ ਸੇਵਾ ਕਰਦਿਆਂ ਅਤੇ ਬਰਤਨ ਦੀ ਸੇਵਾ ਕਰਦਿਆਂ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਮੈਂ ਇਸ ਅਸਥਾਨ 'ਤੇ ਜਾ ਕੇ ਬਹੁਤ ਹੀ ਅਨੁਭਵ ਮਹਿਸੂਸ ਕਰਦੀ ਹਾਂ ਅਤੇ ਆਨੰਦ ਪ੍ਰਾਪਤ ਹੁੰਦਾ ਹੈ